ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਅੱਛਾ ਹਾਂਜੀ ਕੋਈ ਕੰਮ ਕਿਵੇਂ ਫੋਨ ਲਾਇਆ ਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਗਰਮੀਆਂ 'ਚ ਵੈਸੇ ਤਾਂ ਫਸਲਾਂ ਕਾਫੀ ਨੇਗੀਆਂ ਜਿਵੇਂ ਚੌਲ ਹੋ ਗਈ ਮੱਕੀ ਹੋ ਗਈ ਗੰਨਾ ਹੋ ਗਿਆ ਸਬਜ਼ੀਆਂ ਵਗੈਰਾ ਵੀ ਨੇ ਭਿੰਡੀਆਂ ਹੋ ਗਈਆਂ ਕੱਦੂ ਹੋ ਗਏ ਚੌਲੇ ਹੋ ਗਏ ਕਾਫੀ ਸਬਜ਼ੀਆਂ ਅਤੇ ਫਸਲਾਂ ਨੇ ਜਿਹੜੀਆਂ ਆਪਾਂ ਲਗਾ ਸਕਦੇ ਹਾਂ ਅਤੇ ਜਿਹਨਾਂ 'ਚ ਆਪਾਂ ਨੂੰ ਫਾਇਦਾ ਵੀ ਹੈਗਾ ਗਾ ਅਤੇ ਤੁਸੀਂ ਮਤਲਬ ਤੁਸੀਂ ਇਹਨਾਂ 'ਚੋਂ ਕੋਈ ਵੀ ਫਸਲ ਦਾ ਲਗਾਉਣੀ ਹੈ ਤੁਸੀਂ ਲਗਾ ਸਕਦੇ ਹੋਗੇ ਸਬਜ਼ੀਆਂ ਵੀ ਕਾਫੀ ਵਧੀਆ ਨੇ ਮਤਲਬ ਗਰਮੀਆਂ ਦੀ ਰੁੱਤ 'ਚ ਬਾਹਲੀ ਜਿਆਦਾ ਗਰਮੀ 'ਚ ਤਾਂ ਨਹੀਂ ਉਹ ਹਾਂਜੀ ਪਹਿਲੀ ਗਰਮੀ 'ਚ ਤਾਂ ਨਹੀਂ ਉਹ ਮਤਲਬ ਖਰਾਬ ਹੋ ਜਾਂਦੀਆਂ ਨੇ ਪਰ ਊਂ ਠੀਕ ਆ ਮੌਸਮ ਵਧੀਆ ਮੌਸਮ 'ਚ ਹੋ ਜਾਂਦੀਆਂ ਨੇ ਉਹ ਤਾਂ ਵਧੀਆ ਨੇ ਖਾਣ ਪੀਣ ਵਾਲੀਆਂ ਵਧੀਆ ਸਬਜ਼ੀਆਂ ਨੇ ਅਤੇ ਚੌਲ ਵਗੈਰਾ ਵੀ ਵਧੀਆ ਹੈ ਨਾ ਫਸਲਾਂ ਨੇਗੀਆਂ ਤੁਸੀਂ ਕਿਹੜੀ ਮਰਜ਼ੀ ਉਗਾ ਸਕਦੇ ਹੈਗੇ ਸਾਰੀਆਂ 'ਚ ਹੈਗਾ ਤੁਹਾਡਾ ਫਾਇਦਾ ਹਾਂਜੀ ਹਾਂਜੀ ਉਹ ਥੋੜ੍ਹੀ ਨਾ ਜ਼ਿਆਦਾ ਗਰਮੀ ਪੈ ਰਹੀ ਹੈ ਨਾ ਇਸ ਵਾਰ ਉਹਦੇ ਕਰਕੇ ਥੋੜ੍ਹੀ ਮੱਚ ਉਹ ਮੱਚ ਗਈ ਹੋਣੀ ਆ ਤੁਹਾਡੀ ਉਹ ਬੇਲ ਗਰਮੀ ਵੀ ਜ਼ਿਆਦਾ ਨਾ ਇਸ ਵਾਰ ਪਈ ਆ ਉਹਦੇ ਕਰਕੇ ਮੱਚ ਗਈ ਹੋਣੀ ਤੁਸੀਂ ਦੁਬਾਰਾ ਲਾ ਦਿਓ ਹੁਣ ਮਤਲਬ ਮੌਸਮ ਥੋੜ੍ਹਾ ਠੀਕ ਹੈਗਾ ਹੁਣ ਵਧੀਆ ਲੱਗ ਜੂਗੀ ਤੁਸੀਂ ਇੱਕ ਵਾਰ ਮਤਲਬ ਦੁਬਾਰਾ ਲਾ ਦਿਓ ਉਹਨੂੰ ਲਗਾ ਕੇ ਦੇਖ ਲਓ ਵਧੀਆ ਲੱਗ ਜੂਗੀ ਹੋਜੂ ਇਸ ਵਾਰ ਵਧੀਆ ਫਸਲ ਤੁਹਾਡੀ ਹਾਂਜੀ ਹਾਂਜੀ ਇਹਦੇ 'ਚ ਮਤਲਬ ਸਾਡੇ ਵਾਂਗੂ ਬਣਨ ਦੀ ਕੀ ਗੱਲ ਆ ਵਧੀਆ ਤੁਸੀਂ ਕਰ ਸਕਦੇ ਹੋ ਤੁਸੀਂ ਆਪਦੀਆਂ ਫਸਲਾਂ ਬੀਜੋ ਅਤੇ ਇਹਨਾਂ ਨੂੰ ਵੇਚੋ ਹੈ ਨਾ ਤੁਹਾਡੀ ਵਧੀਆ ਕਮਾਈ ਹੋਵੇਗੀ ਵਧੀਆ ਤੁਹਾਡੀਆਂ ਫਸਲਾਂ ਉੱਗਣਗੀਆਂ ਉਹ ਵੈਸੇ ਉਹਦੇ 'ਚੋਂ ਵਾਧਾ ਘਾਟਾ ਵੀ ਹੁੰਦਾ ਰਹਿੰਦਾ ਪੈਸਿਆਂ ਚ ਕਈ ਵਾਰ ਫਸਲ ਖਰਾਬ ਕਈ ਵਾਰ ਫਸਲ ਖਰਾਬ ਹੋ ਜਾਂਦੀ ਹੈ ਤਾਂ ਫਿਰ ਆਪਾਂ ਨੂੰ ਘਾਟਾ ਵੀ ਪੈ ਜਾਂਦਾ ਕਈ ਵਾਰ ਫਸਲ ਜ਼ਿਆਦਾ ਵਧੀਆ ਵੀ ਹੋ ਜਾਂਦੀ ਹੈਗੀ ਹਾਂਜੀ ਇਹ ਮੈਂ ਆਪਣੇ ਡੈਡੀ ਤੋਂ ਸਿੱਖਿਆ ਉਹ ਵੀ ਖੇਤੀ ਕਰਦੇ ਸੀ ਮਤਲਬ ਹੁਣ ਵੀ ਕਰਦੇ ਆ ਉਹ ਮੇਰੇ ਮਤਲਬ ਮੈਂ ਉਹਨਾਂ ਤੋਂ ਹੀ ਸਿੱਖੀ ਹੈਗੀ ਉਹਨਾਂ ਤੋਂ ਹੀ ਮੋਟੀਵੇਟ ਹੋਈ ਹੈਗੀ ਉਹ ਕਰਦੇ ਆ ਖੇਤੀ ਤਾਂ ਫਿਰ ਮੇਰਾ ਵੀ ਮਤਲਬ ਮਨ ਕਰਦਾ ਗਾ ਵੀ ਹਾਂ ਚਲੋ ਆਪਾਂ ਆਪਣੇ ਹਨਾ ਪੇਰੈਂਟਸ ਨਾਲ ਹੱਥ ਵਟਾਈਏ ਕੰਮ 'ਚ ਮਤਲਬ ਮੈਂ ਨਾਲ ਨਾਲ ਕਰਦੀ ਵੀ ਆ ਅਤੇ ਨਾਲ ਨਾਲ ਉਹਨਾਂ ਨਾਲ ਖੇਤੀ ਵੀ ਕਰਾਉਂਦੀ ਹਾਂ ਅਤੇ ਮਤਲਬ ਜ਼ਿਆਦਾਤਰ ਤਾਂ ਹੁਣ ਮੈਨੂੰ ਫਸਲਾਂ ਬਾਰੇ ਪਤਾ ਹੀ ਹੈਗਾ ਵੀ ਕਿਹੜੀਆਂ ਫਸਲਾਂ ਵਧੀਆ ਨੇ ਕਿਹੜੀਆਂ ਹੈ ਨਾ ਮਤਲਬ ਉਗਾਉਣੀਆਂ ਚਾਹੀਦੀਆਂ ਨੇ ਕਿਹਨਾਂ 'ਚ ਆਪਾਂ ਨੂੰ ਫਾਇਦਾ ਗਾ ਹਾਂ ਕੋਈ ਹੋਰ ਕੁਝ ਪੁੱਛਣਾ ਜੀ ਠੀਕ ਆ ਕੋਈ ਗੱਲ ਨਹੀਂ ਧੰਨਵਾਦ ਠੀਕ ਹੈ ਜੀ